ਗੋਡਿਆਂ ਦਾ ਦਰਦ ਆਮ ਤੌਰ 'ਤੇ ਘਰ ਦੇ ਨੁਖਸੇ ਤੇਲ ਦੀ ਮਾਲਿਸ਼ ਗਰਮ ਕਰਕੇ ਅਸੀਂ ਲਾ ਲੈਂਦੇ ਹਾਂ ਅਤੇ ਤੇਲ ਨੂੰ ਗਰਮ ਕਰਦੇ ਹਾਂ ਵਿੱਚ ਮੂਵ ਪਾ ਲੈਂਦੇ ਹਾਂ ਉਹਨੂੰ ਮਾਲਿਸ਼ ਕਰ ਲੈਂਦੇ ਹਾਂ ਅਤੇ ਓਮੋ ਜੈਲ ਵੀ ਲਾ ਲੈਂਦੇ ਹਾਂ ਬੱਚਿਆਂ ਤੋਂ ਮਾਲਿਸ਼ ਵੀ ਕਰਵਾ ਲੈਂਦੇ ਹਾਂ ਯੋਗਾ ਸਵੇਰੇ ਸ਼ਾਮ ਵੀ ਕਰ ਲੈਂਦੇ ਹਾਂ ਬਸ ਜੀ ਸੇਕਾ ਦੇ ਲਈਦਾ ਉਹਨੂੰ ਸੇਕ ਦੇ ਕੇ ਉੱਤੋਂ ਦੀ ਗਰਮ ਪੱਟੀ ਵੀ ਬੰਨ ਲਈਦੀ ਆ ਇੰਨੇ ਨਾਲ ਫਰਕ ਪੈ ਜਾਂਦਾ ਜੀ ਗੋਡਿਆਂ ਦੇ ਦਰਦ ਦਾ ਸਰੋਂ ਦੇ ਤੇਲ ਵਿੱਚ ਅਸੀਂ ਮੂਵ ਪਾ ਕੇ ਉਹਨੂੰ ਮਲਮ ਜਿਹੀ ਬਣ ਜਾਂਦੀ ਹੈ ਉਹਦੀ ਅਸੀਂ ਗੋਡਿਆਂ 'ਤੇ ਮਾਲਿਸ਼ ਕਰ ਲੈਂਦੇ ਹਾਂ